ਸਾਡੇ ਖੇਤਰ ਵਿੱਚ ਇੱਕ ਮਦਾਨ ਆਰਟ ਗੈਲਰੀ ਹੈ ਜੋ ਕਲਾ ਦੇ ਵੱਖ ਵੱਖ ਪ੍ਰਦਰਸ਼ਨ ਕਰਦੀ ਹੈ ਕੋਈ ਇਸ ਵਿੱਚ ਚਿੱਤਰਕਾਰੀ ਬਣਾ ਕੇ ਲੈ ਕੇ ਆਉਂਦਾ ਹੈ ਕੋਈ ਇਸ ਵਿੱਚ ਥਰੀ ਡੀ ਮਾਡਲ ਬਣਾ ਕੇ ਲੈ ਕੇ ਆਉਂਦਾ ਹੈ ਜੋ ਕਿ ਪੁਰਾਣੇ ਤੋਂ ਪੁਰਾਣੇ ਵੀ ਅਤੇ ਨਵੇਂ ਤੋਂ ਨਵੇਂ ਵੀ ਦ੍ਰਿਸ਼ ਪੇਸ਼ ਕਰਦੇ ਹਨ ਐਂਟੀਕ ਦੀ ਤਾਂ ਵ ਗੱਲ ਹੀ ਬਹੁਤ ਵੱਖਰੀ ਹੁੰਦੀ ਹੈ ਇਸ ਤੋਂ ਇਲਾਵਾ ਸਾਡੇ ਖੇਤਰਾਂ ਵਿੱਚ ਸਕੂਲਾਂ ਵਿੱਚ ਵੀ ਕਈ ਪ੍ਰਦਰਸ਼ਨੀਆਂ ਲੱਗਦੀਆਂ ਹਨ ਜਿਸ ਵਿੱਚ ਕਲਾ ਦੇ ਵੱਖ ਵੱਖ ਪ੍ਰਦਰਸ਼ਨ ਕੀਤੇ ਜਾਂਦੇ ਹਨ ਮੈਂ ਵੀ ਆਪਣੇ ਸਕੂਲ ਸਮੇਂ ਵਿੱਚ ਅੰਮ੍ਰਿਤਸਰ ਵਿੱਚ ਇੱਕ ਕਾਲਜ ਵਿੱਚ ਪ੍ਰਦਰਸ਼ਨੀ ਸੀ ਉੱਥੇ ਗਿਆ ਸੀ ਅਤੇ ਕਲਾ ਦੀਆਂ ਜਿੱਥੇ ਚਿੱਤਰਕਾਰੀਆਂ ਅਤੇ ਵੱਖਰੀਆਂ ਵੱਖਰੀਆਂ ਚੀਜ਼ਾਂ ਲੱਗੀਆਂ ਹੋਈਆਂ ਸਨ ਉੱਥੇ ਮੈਂ ਇੱਕ ਕਿਤਾਬ ਖਰੀਦ ਕੇ ਲੈ ਕੇ ਆਇਆ ਜਿਹਦੇ ਵਿੱਚ ਮਖੌਟੇ ਬਣੇ ਹੋਏ ਸਨ ਜਾਨਵਰਾਂ ਦੇ ਮੈਨੂੰ ਹਾਲੇ ਤੱਕ ਯਾਦ ਹੈ ਉਸ ਮਖੌਟਿਆਂ ਨੂੰ ਮੈਂ ਛੋਟੇ ਹੁੰਦੇ ਆਪਣੇ ਚਿਹਰੇ 'ਤੇ ਪਾਉਂਦਾ ਹੁੰਦਾ ਸੀ ਇਹ ਵੀ ਇੱਕ ਕਲਾ ਦੀ ਪ੍ਰਦਰਸ਼ਨੀ ਹੈ ਕਿ ਤੁਸੀਂ ਕਿਸ ਤਰ੍ਹਾਂ ਇੱਕ ਕਲਾਕਾਰ ਨੇ ਮਖੌਟੇ ਕਾਗਜ਼ ਉੱਤੇ ਮਖੌਟੇ ਬਣਾਏ ਰੰਗ ਭਰੇ ਅੱਖਾਂ ਨੂੰ ਦੀ ਥਾਂ ਉਹਨੇ ਕਾਗਜ਼ ਨੂੰ ਕੱਢਿਆ ਅਤੇ ਅਸੀਂ ਉਸਨੂੰ ਆਪਣੇ ਚਿਹਰੇ 'ਤੇ ਲਗਾ ਕੇ ਉਸ ਮਖੌਟੇ ਨੂੰ ਵੇਖ ਸਕਦੇ ਹਾਂ ਇਸ ਨੂੰ ਮੈਂ ਸਮਝ ਕੇ ਅਤੇ ਮੈਂ ਵੀ ਦੋ ਚਾਰ ਤਰ੍ਹਾਂ ਦੇ ਮਖੌਟੇ ਖੁਦ ਬਣਾਏ ਜਿਸ 'ਤੇ ਮੈਨੂੰ ਬਹੁਤ ਹੀ ਖੁਸ਼ੀ ਹੋਈ